ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਕੋਮਲ ਬੋਲ ਰਹੀ ਹੂੰ ਨਹੀਂ ਮੈਂ ਤਾਂ ਨਹੀਂ ਦੇਖਿਆ ਤੁਸੀਂ ਦੇਖਿਆ ਨਹੀਂ ਨਹੀਂ ਮੈਂ ਇੱਕ ਵਾਰ ਤਰਨ ਤਾਰਨ ਵਿੱਚ ਸ਼ੂਟਿੰਗ ਦੇਖਣ ਗਈ ਹੋਈ ਸੀ ਉੱਥੇ ਸ਼ੂਟਿੰਗ ਹੋਈ ਸੀ ਉੱਥੇ ਜਿਹੜੇ ਐਕਟਰ ਆਏ ਹੋਏ ਸੀਗੇ ਉਨ੍ਹਾਂ ਦਾ ਵਰਤਾਓ ਤਾਂ ਬਹੁਤ ਜ਼ਿਆਦਾ ਵਧੀਆ ਸੀਗਾ ਉੱਦਾਂ ਕਾਫ਼ੀ ਜ਼ਿਆਦਾ ਵਧੀਆ ਸੀਗੇ ਹਾਂਜੀ ਇੱਦਾਂ ਦੇ ਕਈ ਐਕਟਰ ਹੈਗੇ ਨੇ ਇਹ ਸਭ ਪਤਾ ਨਹੀਂ ਉਹ ਕਿਉਂ ਕਰਦੇ ਨੇ ਸ਼ਾਇਦ ਇਸ ਲਈ ਕਰਦੇ ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਸੈਲੀਬ੍ਰਿਟੀ ਬਣ ਚੁੱਕੇ ਹਾਂ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈਗਾ ਬਟ ਪਬਲਿਕ ਨੂੰ ਵੀ ਨਾ ਹਰ ਕਿਸੇ ਨੂੰ ਮੈਨੇਜ ਕਰਕੇ ਰੱਖਣਾ ਚਾਹੀਦਾ ਹੈ ਪਬਲਿਕ ਵੀ ਜਦੋਂ ਕਿਸੇ ਇੱਕ ਨੂੰ ਮਤਲਬ ਐਪਰੀਸ਼ੀਏਟ ਕਰਦੀ ਹੈ ਤਾਂ ਉਹਨੂੰ ਹੀ ਕਰੀ ਜਾਂਦੀ ਜਦੋਂ ਕਿਸੇ ਦੇ ਹਾਂਜੀ ਇਹ ਜਦੋਂ ਕਿਸੇ ਜਦੋਂ ਕੋਈ ਉਹਦੀ ਨਵੀਂ ਫਿਲਮ ਨਿਕਲਦੀ ਹੈ ਉਹ ਉਸ ਟਾਈਮ 'ਤੇ ਜਿਸ ਟਾਈਮ ਉਹਦੇ ਪ੍ਰਮੋਸ਼ਨਸ ਹੁੰਦੇ ਆ ਜਦੋਂ ਪ੍ਰਮੋਸ਼ਨਸ ਦੇ ਲਈ ਉਹ ਜਾਂਦੇ ਆ ਉੱਥੇ ਜਦੋਂ ਉਨ੍ਹਾਂ ਨੂੰ ਪਬਲਿਕ ਐਪਰੀਸ਼ੀਏਟ ਕਰਦੀ ਆ ਤਾਂ ਉਹ ਉਸ ਤੋਂ ਕਾਫੀ ਜ਼ਿਆਦਾ ਉਨ੍ਹਾਂ ਨੂੰ ਲੱਗਦਾ ਕਿ ਆਪਾਂ ਕਾਫੀ ਜ਼ਿਆਦਾ ਫੇਮਸ ਹੋ ਚੁੱਕੇ ਹਾਂ ਹਾਂਜੀ ਇਹ ਗੱਲ ਤਾਂ ਹੈਗੀ ਇਹ ਉਨ੍ਹਾਂ ਨੂੰ ਸਮਝਣਾ ਚਾਹੀਦਾ ਪਰ ਉਹ ਨਹੀਂ ਸਮਝਦੇ ਇਸ ਗੱਲ ਨੂੰ ਥੈਂਕਯੂ ਸੋ ਮਚ ਕੋਈ ਗੱਲ ਨਹੀਂ ਏਨੀ ਟਾਈਮ ਸਤਿ ਸ਼੍ਰੀ ਅਕਾਲ